ਖੇਡਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਖੇਡਾਂ ਸਾਡੇ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦੀਆਂ ਹਨ ਇਹ ਸਰੀਰ ਨੂੰ ਫਿੱਟ ਅਤੇ ਚੁਸਤ ਦਰੁਸਤ ਰੱਖਦੀਆਂ ਹਨ ਖੇਡਦੇ ਸਮੇਂ ਜੋ ਪਸੀਨਾ ਆਉਂਦਾ ਹੈ ਉਹ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਦਾ ਹੈ ਇਸ ਨਾਲ ਖੂਨ ਦਾ ਪ੍ਰਵਾਹ ਵੱਧਦਾ ਹੈ ਅਤੇ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ ਇਸ ਨਾਲ ਵਿਅਕਤੀ ਦੀ ਕੁਸ਼ਲਤਾ ਵੱਧਦੀ ਹੈ ਸੁਆਮੀ ਵਿਵੇਕਾਨੰਦ ਨੇ ਵੀ ਕਿਹਾ ਕਿ ਫੁੱਟਬਾਲ ਖੇਡ ਕੇ ਸਵਰਗ ਦੇ ਨੇੜੇ ਜਾ ਸਕਦਾ ਹੈ ਇਸ ਨਾਲ ਵਿਅਕਤੀ ਦੀਆਂ ਬਾਹਾਂ ਮਜ਼ਬੂਤ ਹੁੰਦੀਆਂ ਹਨ ਗੁੱਟ ਮਜ਼ਬੂਤ ਹੁੰਦੇ ਹਨ ਅੱਜ ਮਨੁੱਖ ਨੂੰ ਆਪਣੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਸ ਕਾਰਨ ਥੱਕੇ ਹੋਏ ਸਰੀਰ ਅਤੇ ਮਨ ਨੂੰ ਆਰਾਮ ਦੀ ਲੋੜ ਹੁੰਦੀ ਹੈ ਮੰਜੇ 'ਤੇ ਲੇਟ ਕੇ ਸਰੀਰ ਦੀ ਥਕਾਵਟ ਦੂਰ ਕੀਤੀ ਜਾ ਸਕਦੀ ਹੈ